ਬੱਚਿਆਂ 'ਤੇ ਇਸ ਨਵੀਂ ਟੈਕਨੋਲੋਜੀ ਦਾ ਅਸਰ ਕੁਝ ਜ਼ਿਆਦਾ ਹੀ ਹੈ ਉਹ ਸਾਰਾ ਦਿਨ ਮੋਬਾਈਲ ਜਾਂ ਆਪਣੇ ਲੈਪਟੋਪ ਨਾਲ ਹੀ ਲੱਗੇ ਰਹਿੰਦੇ ਹਨ ਜਿਹੜਾ ਕਿ ਬਹੁਤ ਨੁਕਸਾਨਦਾਇਕ ਹੈ ਬੱਚਿਆਂ ਦੀ ਸ ਸਿਹਤ 'ਤੇ ਵੀ ਫਰਕ ਪਾਉਂਦਾ ਹੈ ਅਤੇ ਉਹਨਾਂ ਦੇ ਅੱਗੇ ਆਉਣ ਵਾਲੇ ਸ ਸਮੇਂ 'ਤੇ ਵੀ ਫਰਕ ਪਾਉਂਦਾ ਹੈ ਬੱਚਿਆਂ ਦੀ ਦ ਦੇਖਭਾਲ ਕਰਨੀ ਚਾਹੀਦੀ ਹੈ